ਹੈਲੋ ਸਰ ਮੈਂ ਤੁਹਾਡੀ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੀ ਹਾਂ ਅਤੇ ਮੈਂ ਮਤਲਬ ਆਪਣੀ ਛੁੱਟੀਆਂ ਮਤਲਬ ਜਿਹੜੀਆਂ ਹੁਣ ਅੱਗੇ ਛੁੱਟੀਆਂ ਆ ਰਹੀਆਂ ਹਨ ਅਤੇ ਮੈਂ ਇਹਨਾਂ ਛੁੱਟੀਆਂ ਦੇ ਵਿੱਚ ਮਤਲਬ ਛੁੱਟੀਆਂ ਕਰਕੇ ਕਿਤੇ ਘੁੰਮਣ ਜਾਣ ਦਾ ਪਲਾਨ ਬਣਾਇਆ ਹੈ ਅਤੇ ਮੈਂ ਮਤਲਬ ਇਹ ਜਾਣਨਾ ਚਾਹੁੰਦੀ ਸੀ ਕਿ ਮੈਂ ਇਹ ਜਾਨਣ ਦੀ ਇਛੁੱਕ ਸੀਗੀ ਕਿ ਜਿਹੜਾ ਮੇਰਾ ਇਨਕਮ ਟੈਕਸ ਰਿਫੰਡ ਹੈ ਅਤੇ ਮੇਰੇ ਰਿਫੰਡ ਦੀ ਕੀ ਪ੍ਰਤੀਕਿਰਿਆ ਏ ਮੈਂ ਇਹਦੇ ਬਾਰੇ ਸਾਰਾ ਜਿਹੜੀ ਪ੍ਰਕਿਰਿਆ ਇਹਦੀ ਚੱਲ ਰਹੀ ਹੈ ਮੈਂ ਜਾਣਨਾ ਚਾਹੁੰਦੀ ਸੀ ਤਾਂ ਕਿ ਮਤਲਬ ਮੈਂ ਜਿਹੜੀ ਆਪਣੀ ਜਿਹੜੀ ਛੁੱਟੀਆਂ ਹੈ ਆਪਣੀ ਛੁੱਟੀਆਂ ਨੂੰ ਮਤਲਬ ਵਧੀਆ ਤਰੀਕੇ ਨਾਲ ਛੁੱਟੀਆਂ ਦਾ ਆਨੰਦ ਮਾਣ ਸਕਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਜਿਹੜੀ ਇਨਕਮ ਟੈਕਸ ਦੀ ਜਿਹੜੀ ਇਹ ਚੱਲ ਰਹੀ ਪ੍ਰਤੀਕਿਰਿਆ ਹੈ ਮੈਨੂੰ ਜਲਦੀ ਤੋਂ ਜਲਦੀ ਮੈਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ ਅਤੇ ਮੇਰੀ ਜਿਹੜੀ ਰਸੀਦ ਨੰਬਰ ਹੈ ਮੈਂ ਅੱਜ ਜਮ੍ਹਾਂ ਕਰਵਾ ਦਿੱਤੀ ਸੀ ਅਤੇ ਮੇਰਾ ਪੈਨ ਕਾਰਡ ਦੇ ਆਖਰੀ ਚਾਰ ਅੱਖਰ ਹਨ ਫ਼ੋਰ ਸਿਕਸ ਥ੍ਰੀ ਫ਼ੋਰ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਮਤਲਬ ਇਸ ਦੀ ਜਿਹੜੀ ਹੈਗੀ ਆਨਲਾਈਨ ਜਿਹੜੀ ਮਤਲਬ ਮੇਰੀ ਜਿਹੜੀ ਇਸ ਪ੍ਰਤੀਕਿਰਿਆ ਦੀ ਜਿਹੜੀ ਸਥਿਤੀ ਹੈ ਉਹ ਮੈਨੂੰ ਜਲਦ ਤੋਂ ਜਲਦ ਮਤਲਬ ਪ੍ਰਾਪਤ ਹੋ ਜਾਏ ਤਾਂ ਕਿ ਮੈਂ ਜਿਹੜਾ ਆਪਣਾ ਮਤਲਬ ਅੱਗੇ ਜਿਹੜੀ ਛੁੱਟੀਆਂ ਏ ਮਤਲਬ ਆਪਣੇ ਆਨੰਦ ਮਾਣ ਸਕਾਂ ਹਾਂ ਇਸ ਲਈ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ ਅਤੇ ਪਲੀਜ਼ ਮੈਨੂੰ ਮੇਰੀ ਜਿਹੜੀ ਪ੍ਰਤੀਕਿਰਿਆ ਹੈ ਉਹਦੀ ਜਲਦੀ ਤੋਂ ਜਲਦੀ ਜਾਂਚ ਪ੍ਰਾਪਤ ਹੋ ਜਾਏ